ਅੱਜ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਆ ਗਈਆਂ ਨੇ ਸਿਹਤ ਦੇ ਲਈ ਜੋ ਡੋਕਟਰਾਂ ਵੱਲੋਂ ਵਰਤੀਆਂ ਜਾ ਰਹੀਆਂ ਨੇ ਅਤੇ ਇਸ ਦੇ ਨਾਲ਼ ਬਹੁਤ ਸਾਰੇ ਓਪਰੇਟਸ ਵੀ ਡੋਕਟਰਾਂ ਕੋਲ ਆ ਚੁੱਕੇ ਨੇ ਜਿਹਦੇ ਨਾਲ਼ ਡੋਕਟਰ ਲੋਕਾਂ ਦਾ ਇਲਾਜ ਕਰਦੇ ਨੇ ਅਤੇ ਮੌਸਟਲੀ ਜਿਹੜਾ ਦੇਖਿਆ ਜਾਵੇ ਅੱਜ ਕੱਲ੍ਹ ਦੇ ਜਿਹੜੇ ਓਪਰੇਟਸ ਨਵੇਂ ਆਏ ਨੇ ਉਹਨਾਂ ਦੇ ਵਿੱਚ ਮਰੀਜ਼ਾਂ ਦੀ ਜਿਹੜੀ ਸਾਰੀ ਜਾਣਕਾਰੀ ਹੈ ਪੂਰੀ ਬੌਡੀ ਦੀ ਪੁਰਾਣੇ ਸਮੇਂ ਦੀ ਉਹ ਵੀ ਸਟੋਰ ਕਰਕੇ ਰੱਖੀ ਜਾਂਦੀ ਆ ਅਤੇ ਉਹ ਪੂਰੀ ਬੌਡੀ ਦਾ ਚੈੱਕਅੱਪ ਕਰਕੇ ਉਹਦੇ ਨਾਲ਼ ਰੀਲੇਟ ਕਰਕੇ ਉਹਨਾਂ ਨੂੰ ਸਾਰਾ ਪਰੋਪਰ ਗਾਈਡ ਕਰਦੇ ਨੇ ਕਿ ਇਹ ਤੁਹਾਡੇ ਸਰੀਰ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਆ ਅਤੇ ਉਸ ਨੂੰ ਠੀਕ ਕਰਨ ਦੇ ਵਿੱਚ ਪੂਰੀ ਤਰ੍ਹਾਂ ਮਰੀਜ਼ ਦੀ ਸਹਾਇਤਾ ਕਰਦੇ ਨੇ